ਪੰਜਾਬ ਵਿੱਚ ਖੋ ਨਵੀਆਂ ਨਵੀਆਂ ਖੋਜਾਂ ਦੇ ਨਵੀਨਤਾ ਦੇ ਕੇਂਦਰ ਵੀ ਖੁੱਲ੍ਹੇ ਨੇ ਜਿਹੜੇ ਕਿ ਸਿਖਾਂਦੇ ਨੇ ਉਸ ਖੇਤਰ ਦੇ ਵਿੱਚ ਜਿਨ ਜਿਵੇਂ ਕਿ ਆਈ ਆਈ ਟੀ ਰੋਪੜ ਪੰਜਾਬ ਐਗਰੀਕਲਚਰ ਯੂਨੀਵਰਸਟੀ ਅਤੇ ਆਈ ਆਈ ਐੱਸ ਸੀ ਆਰ ਮੋਹਾਲੀ ਇਹ ਸਾਰੇ ਹੀ ਜਿਹੜੇ ਹੈਗੇ ਆ ਥਰੈਟੀਕਲ ਨੌਲੇਜ ਹੀ ਨਹੀਂ ਦਿੰਦੇ ਸਿਰਫ਼ ਪ੍ਰੈਕਟੀਕਲੀ ਨੌਲੇਜ ਵੀ ਦੇ ਰਹੇ ਆ ਤਾਂ ਤੁਹਾਨੂੰ ਇੱਕ ਸਕਿੱਲ ਦੇ ਰਹੇ ਆ ਹੁਣ ਜੋ ਵੀ ਅਸੀਂ ਕੰਮ ਕਰਦੇ ਹਾਂ ਸਾਨੂੰ ਉਹਦਾ ਅਸੀਂ ਅ ਥਰੈਟੀਕਲ ਕਰਕੇ ਤਾਂ ਸਾਨੂੰ ਨਹੀਂ ਪਤਾ ਚੱਲਦਾ ਪਰ ਪ੍ਰੈਕਟੀਕਲੀ ਜਿਸ ਵੇਲੇ ਅਸੀਂ ਕਰਦੇ ਤਾਂ ਉਹ ਸਾਨੂੰ ਉਹਦੀ ਜ਼ਿਆਦਾ ਨੌਲੇਜ ਮਿਲਦੀ ਜਿਸ ਤਰ੍ਹਾਂ ਕਿ ਹੁਣ ਔਨਲਾਈਨ ਅਸੀਂ ਕੰਮ ਕਰਨ ਲੱਗ ਪਏ ਹਾਂ ਔਨਲਾਈਨ ਪੜ੍ਹਨ ਵੀ ਲੱਗ ਪਏ ਹਾਂ ਕੋਡਿੰਗ ਵਗੈਰਾ ਵੀ ਆ ਗਈ ਆ ਜਾਂ ਡਿਜ਼ੀਟਲ ਹਰ ਚੀਜ਼ਾਂ ਹੋ ਰਹੀਆਂ ਹਰ ਪੇਮੈਂਟ ਵਗੈਰਾ ਅਡਿਜ਼ੀਟਲ ਹੋ ਰਹੀ ਹੈ ਹਰ ਚੀਜ਼ ਅਸੀਂ ਔਨਲਾਈਨ ਲੇ ਲੈ ਰਹੇ ਹਾਂ ਔਨਲਾਈਨ ਪੇਮੈਂਟ ਕਰ ਰਹੇ ਹਾਂ ਇੰਨੀ ਦੂਰ ਦੂਰ ਅਤੇ ਇਹ ਸਾਨੂੰ ਕਾਫ਼ੀ ਸਹੂਲਤਾਂ ਮਿਲੀਆਂ ਵੈ ਇਹ ਨਵੀਆਂ ਨਵੀਆਂ ਜਿਹੜੀਆਂ ਸਾਡੇ ਖੋਜਾਂ ਹੋ ਰਹੀਆਂ ਵੈ ਉਹਦੇ ਕਰਕੇ ਅਸੀਂ ਇਹ ਕਾਫ਼ੀ ਫਾਇਦਾ ਉਠਾ ਰਹੇ ਹਾਂ ਪਰ ਥਰੈਟੀਕਲ ਨੌਲੇਜ ਦੇ ਨਾਲ ਅਸੀਂ ਸਾਨੂੰ ਜੇ ਅਸੀਂ ਪ੍ਰੈਕਟੀਕਲ 'ਤੇ ਵੀ ਜੋਰ ਦੇਵਾਂਗੇ ਫਿਰ ਹੀ ਇਹਦਾ ਜ਼ਿਆਦਾ ਫਾਇਦਾ ਉਠਾ ਸਕਦੇ ਹਾਂ ਔਰ ਹੁਣ ਸਾਡੇ ਦੇਸ਼ ਨੇ ਕਾਫ਼ੀ ਡਿਜ਼ੀਟਲ ਤਰੱਕੀ ਕਰ ਲਈ ਹੈ ਕਿ ਅਸੀਂ ਇੱਥੇ ਬੈਠੇ ਹੋਏ ਵੀ ਦੂਰੋਂ ਇੰਨੀ ਚੀਜ਼ ਮੰਗਵਾ ਸਕਦੇ ਹਾਂ ਫਿਰ ਦੂਰ ਇੰਨੀ ਚੀਜ਼ ਭੇਜ ਸਕਦੇ ਹਾਂ ਅਤੇ ਹੁਣ ਸਾਡੇ ਦੇਸ਼ 'ਚ ਜਿਹੜੀ ਡਿਜ਼ੀਟਲ ਕ੍ਰਾਂਤੀ ਆਈ ਹੈ ਉਹਦੇ ਨਾਲ ਕਾਫ਼ੀ ਜ਼ਿਆਦਾ ਇੰਪਰੂਵਮੈਂਟ ਹੋ ਗਈ ਹੈ ਅਤੇ ਅਸੀਂ ਕਾਫ਼ੀ ਸੁੱਖ ਉਹਦੇ ਨਾਲ ਉਠਾ ਰਹੇ ਹਾਂ ਔਰ ਸਾਡੇ ਨਵੇਂ ਨਵੇਂ ਸਕਿੱਲ ਉਜਾਰ ਹੋ ਰਹੇ ਆ ਜਿਹਦੇ ਕਰਕੇ ਇੰਡੀਆ ਕਾਫ਼ੀ ਅੱਗੇ ਆ ਰਿਹਾ